ਜੋ ਸਭ ਤੋਂ ਵੱਡਾ ਜੋ ਪ੍ਰਭਾਵ ਹੈ ਕਿ ਲੋਕ ਖੇਡਾਂ ਵੱਲ ਉਤਸ਼ਾਹਿਤ ਹੋਣ ਅਤੇ ਖੇਡਾਂ ਦੀ ਜੋ ਗੁਣਵੱਤਾ ਹੈ ਉਹਨੂੰ ਪਛਾਣ ਸਕਣ ਉਹ ਹੈ ਸਿਹਤ ਦੀ ਸੰਭਾਲ ਕਿਉਂਕਿ ਜਦੋਂ ਆਪਾਂ ਕੋਈ ਵੀ ਖੇਡ ਖੇਡਦੇ ਹਨ ਉਹਦੇ ਕਰਕੇ ਸਾਡਾ ਜੋ ਸਰੀਰ ਹੈ ਉਹ ਕਾਫੀ ਵਧੀਆ ਤੌਰ 'ਤੇ ਵਿਕਸਿਤ ਕਰਦਾ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਖੇਡਾਂ ਦੂਰ ਰੱਖਦੀਆਂ ਹਨ ਅਤੇ ਜੋ ਖੇਡਾਂ ਖੇਡਦੇ ਹਨ ਜੋ ਵੱਡੇ ਪੱਧਰ 'ਤੇ ਬਾਹਰਲੇ ਦੇਸ਼ਾਂ ਵਿੱਚ ਜਾਂ ਨੈਸ਼ਨਲ ਪੱਧਰ 'ਤੇ ਇੰਟਰਨੈਸ਼ਨਲ ਪੱਧਰ 'ਤੇ ਜੋ ਖੇਡਾਂ ਖੇਡ ਕੇ ਖਿਡਾਰੀ ਆਉਂਦੇ ਹਨ ਉਹਨਾਂ ਨੂੰ ਸਰਕਾਰ ਵੱਲੋਂ ਜੋ ਵਿੱਤੀ ਸਹਾਇਤਾ ਹੁੰਦੀ ਹੈ ਉਹ ਵੱਡੇ ਪੱਧਰ 'ਤੇ ਵੀ ਦਿੱਤੀ ਜਾਂਦੀ ਹੈ ਅਤੇ ਵੱਡੀਆਂ ਵੱਡੀਆਂ ਨੌਕਰੀਆਂ ਦੇ ਕੇ ਵੀ ਨਿਵਾਜਿਆ ਜਾਂਦਾ ਹੈ ਅਤੇ ਇਸ ਲਈ ਸਾਨੂੰ ਲੋੜ ਹੈ ਕਿ ਆਪਾਂ ਖੇਡਾਂ ਦੀ ਜੋ ਗੁਣਵੱਤਾ ਹੈ ਉਹਨੂੰ ਪਛਾਣੀਏ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਈਏ ਜਿਹਦੇ ਕਰਕੇ ਸਾਨੂੰ ਸਿਹਤ ਦੀ ਸੰਭਾਲ ਅਤੇ ਨਿੱਜੀ ਤੌਰ 'ਤੇ ਵਿੱਤੀ ਸਹਾਇਤਾ ਵੀ ਜੋ ਮਿਲਦੀ ਹੈ ਕਿਉਂਕਿ ਅੱਜ ਕੱਲ੍ਹ ਖੇਡਾਂ ਵਿੱਚ ਕਾਫੀ ਜੋ ਬੱਚਿਆਂ ਦਾ ਭਵਿੱਖ ਹੈ ਉਹ ਵਧੀਆ ਬਣਦਾ ਹੈ ਕਿਉਂਕਿ ਸਰਕਾਰ ਵੀ ਕਾਫੀ ਯੋਗਦਾਨ ਜੋ ਖੇਡਾਂ ਪ੍ਰਤੀ ਦਿੰਦੀ ਹੈ